ਆਮ ਤੌਰ 'ਤੇ ਮੈਂ ਤਾਂ ਬਹੁਤ ਸਾਰੀਆਂ ਚੀਜ਼ਾਂ 'ਤੇ ਪੇਂਟਿੰਗ ਵਗੈਰਾ ਕਰ ਲੈਂਦੀ ਹਾਂ ਸਾਰੀ ਚੀਜ਼ਾਂ 'ਤੇ ਵੈਸੇ ਮੈਨੂੰ ਪੇਂਟ ਕਰਨਾ ਬਹੁਤ ਵਧੀਆ ਲੱਗਦਾ ਆ ਤਾਂ ਹੁਣ ਦੇਖੋ ਕੈਨਵਸ ਹੈ ਕੈਨਵਸ ਜਿਹੜਾ ਵਾ ਉਹਦੇ ਨਾਲ ਕੀ ਹੁੰਦਾ ਵਾ ਕਿ ਉਹਦੀ ਬਹੁਤ ਵਧੀਆ ਉਹਦੇ ਸਟੈਂਡ ਦੇ ਨਾਲ ਸਪੋਰਟ ਮਿਲ ਜਾਂਦੀ ਹੈ ਕੁਝ ਵੀ ਮੈਂ ਡ੍ਰੋ ਕਰਨਾ ਹੁੰਦਾ ਤਾਂ ਮਤਲਬ ਕੋਈ ਵੀ ਚਿੱਤਰ ਬਣਾਉਣਾ ਹੁੰਦਾ ਆ ਉਹਦੇ ਨਾਲ ਕੀ ਹੈ ਇੱਕ ਸਪੋਰਟ ਦੇ ਨਾਲ ਜਿਹੜੀ ਆ ਕੋਈ ਵੀ ਮਤਲਬ ਗਲਤੀ ਹੋਣ ਦੀ ਜਿਹੜੀ ਸੰਭਾਵਨਾ ਉਹ ਘੱਟ ਜਾਂਦੀ ਹੈ ਅਤੇ ਜਿਹੜੀ ਚਾਰਟ ਪੇਪਰ ਦੀ ਗੱਲ ਲੈ ਲਓ ਤੁਸੀਂ ਉਹਦੇ ਵਿੱਚ ਕੀ ਆ ਕਿ ਇਹਏ ਸਾਰਾ ਚੀਜ਼ ਜਿਹੜੀ ਡਿਪੈਂਡ ਕਰਦੀ ਹੈ ਕਿ ਆਪਾਂ ਬਣਾਉਣਾ ਕੀ ਚਾਹੁੰਦੇ ਹਾਂ ਦੇਖੋ ਚਾਰਟ ਪੇਪਰ 'ਤੇ ਆਪਾਂ ਕੁਝ ਬਣਾਵਾਂਗੇ ਤਾਂ ਉਹਨੂੰ ਆਪਾਂ ਪੈਨਸਿਲ ਦੇ ਨਾਲ ਵੀ ਜਿਹੜਾ ਸ਼ੇਡ ਕਰਕੇ ਉਹਨੂੰ ਰਬ ਵੀ ਕਰ ਸਕਦੇ ਜੇ ਕੋਈ ਗਲਤੀ ਹੋ ਜਾਵੇ ਤਾਂ ਅਤੇ ਉਹਦੇ ਨਾਲ ਨਾਲ ਕੀ ਹੈ ਜੇ ਹੁਣ ਆਪਣਾ ਡਿਪੈਂਡ ਕਰਦਾ ਜੇ ਆਪਾਂ ਕੋਈ ਕਲਰਫੁੱਲ ਚੀਜ਼ ਰੰਗੀਨ ਜਿਹੜਾ ਚਿੱਤਰ ਬਣਾਉਣਾ ਆ ਉਹਦੇ ਨਾਲ ਕੀ ਹੈ ਆਪਾਂ ਵਾਟਰ ਕਲਰ ਜਿਹੜੇ ਯੂਜ ਕਰ ਸਕਦੇ ਹਾਂ ਵਾਟਰ ਕਲਰ ਦੇ ਨਾਲ ਕੀ ਆ ਉਹਦੀ ਜਿਹੜੀ ਅੰਦਰ ਦੀ ਜਿਹੜੀ ਖੂਬਸੂਰਤੀ ਹੈ ਤਸਵੀਰ ਦੀ ਉਹ ਉਭਰ ਕੇ ਆਉਂਦੀ ਹੈ ਉਹਦੇ ਨਾਲ ਦੇਖਣ ਵਾਲੇ ਨੂੰ ਵੀ ਬੜਾ ਪ੍ਰਭਾਵ ਪੈਂਦਾ ਕਿ ਹਾਂ ਇਹ ਸ਼ਾਇਦ ਇਹ 'ਚ ਇੰਨਾਂ ਟੈਲੈਂਟ ਹੈ ਬੰਦੇ ਦੇ ਇੱਕ ਪੇਂਟਰ ਦੇ ਅੰਦਰ ਦਾ ਜਿਹੜਾ ਟੈਲੈਂਟ ਆ ਇਹ ਚੀਜ਼ ਉਭਰ ਕੇ ਆਉਂਦੀ ਆ ਇਹ ਸਭ ਕੁਛ ਡਿਪੈਂਡ ਵਾ ਆਪਾਂ ਕਿਹੜੇ ਤਰ੍ਹਾਂ ਦੇ ਜਿਹੜੇ ਕਲਰ ਉਹਤੇ ਵਰਤ ਦੇ ਹਾਂ ਜਾਂ ਹੋਰ ਕਿਹੜੇ ਆ ਜਾਂ ਸ਼ੇਡਿੰਗ ਦੇ ਨਾਲ ਬਣਾਉਦੇ ਹਾਂ ਕਿ ਅੰਦਰ ਦੇ ਜਿਹੜਾ ਵਾ ਪੂਰਾ ਇੱਕ ਪੇਂਟਰ ਦੀ ਜਿਹੜੀ ਆ ਅੰਦਰਲੀਆਂ ਭਾਵਨਾਵਾਂ ਵਾ ਨਾ ਉਹ ਪੇਂਟਰ ਪੂਰੀ ਤਰ੍ਹਾਂ ਉਹ 'ਤੇ ਲਗਾ ਦਿੰਦਾ ਵਾ ਕਿ ਮੈਂ ਹੁਣ ਆਪਣੇ ਅੰਦਰ ਦੀਆਂ ਫੀਲਿੰਗਸ ਨੂੰ ਜਿਹੜੀਆਂ ਭਾਵਨਾਵਾਂ ਉਹ ਕਿਸ ਤਰ੍ਹਾਂ ਵਿਅਕਤ ਕਰਨੀਆਂ ਨੇ